ਮੈਂ ਗੁਰਲਾਲ ਮਾਨਾਂਵਾਲਾ ਦਾ ਰਹਿਣ ਵਾਲਾ ਹਾਂ ਕੁੱਝ ਦਿਨ ਪਹਿਲਾਂ ਸਾਡੇ ਇੱਥੇ ਬਹੁਤ ਬਾਰਿਸ਼ ਹੋ ਰਹੀ ਸੀ ਅਤੇ ਅਚਾਨਕ ਹੀ ਸਾਡੇ ਘਰ ਕੁੱਝ ਮਹਿਮਾਨ ਆ ਗਏ ਮੈਂ ਸੋਚਿਆ ਕਿ ਘਰ ਖਾਣਾ ਬਣਾਉਣ ਦੇ ਬਜਾਏ ਹੋਟਲ ਤੋਂ ਹੀ ਮੰਗਵਾ ਲੈਂਦੇ ਹਾਂ ਸਾਡੇ ਲਾਗੇ ਚਾਵਲਾ ਹੋਟਲ ਹੈ ਜੋ ਮੈਂ ਹੋਮ ਜੋ ਹੋਮ ਸਰਵਿਸ ਦਿੰਦੇ ਹਨ ਮੈਂ ਇਹਨਾਂ ਤੋਂ ਭੋਜਨ ਔਡਰ ਕੀਤਾ ਸੀ ਇਹਨਾਂ ਨੇ ਬਿਨਾਂ ਕਿਸੇ ਮੁਸ਼ਕਿਲ ਦੇ ਸਾਡੇ ਘਰ ਸਾਰਾ ਭੋਜਨ ਭੇਜ ਦਿੱਤਾ ਬਾਰਿਸ਼ ਹੁੰਦੀ ਦੇ ਵਿੱਚ ਹੀ ਡਿਲੀਵਰੀ ਬੋਇਜ਼ ਡਿਲੀਵਰੀ ਬੋਆਏ ਭੋਜਨ ਦੇ ਕੇ ਗਿਆ ਉਹਨਾਂ ਦੀ ਸਰਵਿਸ ਮੈਨੂੰ ਬਹੁਤ ਹੀ ਵਧੀਆ ਲੱਗੀ ਮੈਂ ਬਹੁਤ ਖੁਸ਼ ਹਾਂ ਇਹਨਾਂ ਦੀ ਸਰਵਿਸ ਤੋਂ ਧੰਨਵਾਦ